ਅੱਜ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਚੁਣੌਤੀਆਂ ਇਹ ਹਨ ਕਿ ਹੜ੍ਹਾਂ ਦੇ ਕਾਰਨ ਥੋ ਜਗ੍ਹਾਂ ਜਗ੍ਹਾਂ ਤੋਂ ਨਦੀਆਂ ਅਤੇ ਨਹਿਰਾਂ ਟੁੱਟੀਆਂ ਹੋਈਆਂ ਹਨ ਅਤੇ ਉਹਨਾਂ 'ਤੇ ਸਰਕਾਰ ਕੰਮ ਚੱਲ ਰਿਹਾ ਹੈ ਅਤੇ ਸਰਕਾਰ ਬਹੁਤ ਹੀ ਵਧੀਆ ਤਰੀਕੇ ਨਾਲ ਹੱਲ ਕਰ ਰਹੀ ਹੈ ਅਤੇ ਉਹਨਾਂ 'ਤੇ ਪੋਕਲਾਈਨ ਮਸ਼ੀਨਾਂ ਲਗਾ ਕੇ ਵਧੀਆ ਢੰਗ ਨਾਲ ਨਹਿਰਾਂ 'ਤੇ ਕੰਮ ਕਰ ਰਹੀ ਹੈ ਕਰਵਾ ਰਹੀ ਹੈ ਅਤੇ ਵਧੀ ਬੰਨ੍ਹ ਜਿਹੜੇ ਟੁੱਟੇ ਹੋਏ ਬੰਨ੍ਹ ਹਨ ਉਹਨਾਂ ਨੂੰ ਸਵਾਰ ਰਹੀ ਹੈ